ਹਾਂ ਮੈਂ ਪੇਂਟਿੰਗ ਬੁਰਸ਼ ਅਤੇ ਪੇਂਟਿੰਗ ਚਾਕੂ ਵਰਤਦੀ ਹਾਂ ਕਿਉਂਕਿ ਮੈਂ ਪੇਂਟਿੰਗ ਬੁਰਸ਼ ਨਾਲ ਕਦੇ ਕਦੇ ਪੇਜ਼ ਉੱਪਰ ਪੇਂਟਿੰਗ ਕਰਦੀ ਹਾਂ ਅਤੇ ਮੈਂ ਪੇਂਟਿੰਗ ਸੂਟਾਂ ਉੱਪਰ ਵੀ ਕਰਦੀ ਹਾਂ ਅਤੇ ਮੈਂ ਉਹਨਾਂ ਨੂੰ ਸੇਲ ਕਰਦੀ ਹਾਂ ਪੇਂਟਿੰਗ ਚਾਕੂ ਉਹ ਮੈਂ ਦਰੀਆਂ ਵਾਸਤੇ ਕਰਦੀ ਹਾਂ ਚਾਦਰਾ ਪੇਂ ਪੇਂਟਿੰਗ ਬੁਰਸ਼ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਰਾਇਲ ਅਤੇ ਲੈਗਨਿਕ ਕਰੋਮ ਆਰਟੀਓਸ ਸਭ ਤੋਂ ਚੰਗੇ ਕੈਂਪ ਦੋ ਤਰ੍ਹਾਂ ਦੇ ਹੁੰਦੇ ਹਨ ਪਰਡੀ ਬੈਂਡ ਅਤੇ ਕਰੋਨਾ ਬ੍ਰਾਂਡ ਮੈਨੂੰ ਇਹ ਦੋਨੇ ਹੀ ਵਧੀਆ ਲੱਗਦੇ ਹਨ ਵੱਡੇ ਵੱਡੇ ਚਿੱਤਰਕਾਰ ਇਹਨਾਂ ਦੋਨਾਂ ਵਿਚਕਾਰ ਆਪਣੀ ਨਿੱਜੀ ਤਰਜੀਹ ਕਰਦੇ ਹਨ ਅਤੇ ਸਭ ਤੋਂ ਵਧੀਆ ਬਰੈਂਡ ਹਨ ਇਹ ਮਜ਼ਬੂਤ ਹੁੰਦੇ ਹਨ ਇਹ ਛੇਤੀ ਟੁੱਟਦੇ ਨਹੀਂ ਅਤੇ ਲੰਬੇ ਸਮੇਂ ਤੱਕ ਚਲਦੇ ਹਨ